ਹਾਂਜੀ ਮੈਂ ਰਵਾਇਤੀ ਤੌਰ 'ਚ ਪੈੱਨ ਦੇ ਨਾਲ ਲਿਖਣਾ ਪਸੰਦ ਕਰਦੀ ਹਾਂ ਕਿਉਂਕਿ ਆਹ ਸਾਡੇ ਜ਼ਮਾਨੇ 'ਚ ਤਾਂ ਚਲੋ ਲਿਖਣ ਲਿਖਣ ਦੇ ਆਪਣੇ ਹੈਂਡਰਾਈਟਿੰਗ ਨੂੰ ਸੁਧਾਰਨ ਲਈ ਆਪਾਂ ਵੱਧ ਤੋਂ ਵੱਧ ਲਿਖਦੇ ਹੁੰਦੇ ਸੀ ਪਰ ਅੱਜ ਦਾ ਜ਼ਮਾਨਾ ਜੋ ਹੈ ਉਹ ਲਿਖਣਾ ਪਸੰਦ ਨਹੀਂ ਕਰਦਾ ਕਿਉਂਕਿ ਅੱਜ ਦੇ ਜ਼ਮਾਨਾ ਜੋ ਹੈ ਉਹ ਟ ਉਹ ਟਾਈਪਿੰਗ ਨੂੰ ਪਸੰਦ ਕਰਦਾ ਹੈ ਪਰ ਉਹਨਾਂ ਦੇ ਹਿਸਾਬ ਨਾਲ ਉਹ ਠੀਕ ਵੀ ਹੈ ਕਿਉਂਕਿ ਇਹ ਜ਼ਮਾਨਾ ਕੋਡਿੰਗ ਦਾ ਹੈ ਅਤੇ ਜਿਹੜਾ ਬੱਚਾ ਫਾਸਟ ਤੋਂ ਫਾਸਟ ਕੋਡਿੰਗ ਕਰੇਗਾ ਉਹੀ ਬੱਚਾ ਉਸ ਬੱਚੇ ਨੂੰ ਹੀ ਸਲੈਕਟ ਕੀਤਾ ਜਾਂਦਾ ਏ ਉਹਨਾਂ ਨੂੰ ਅਸੀਂ ਗਲਤ ਵੀ ਹੀ ਗਲਤ ਵੀ ਨਹੀਂ ਕਹਿ ਸਕਦੇ ਪਰ ਕਿਤੇ ਨਾ ਕਿਤੇ ਅਸੀਂ ਆਪਣੀ ਨੈਚੁਰਲ ਚੀਜ਼ ਤੋਂ ਪਿੱਛੇ ਜਾ ਰਹੇ ਹਾਂ ਇਹ ਬਹੁਤ ਮੈਨੂੰ ਗਲਤ ਚੀਜ਼ ਲੱਗਦੀ ਹੈ ਕਿਉਂਕਿ ਲਿਖਣਾ ਜਿਵੇਂ ਅਸੀਂ ਪੇਪਰ ਦੇ ਵਿੱਚ ਆ ਪੇਪਰ ਦੇ ਵਿੱਚ ਲਿਖਣਾ ਜੀ ਸਾਡੀ ਹੈਂਡਰਾਈਟਿੰਗ ਫਾਸਟ ਹੋਏਗੀ ਅਤੇ ਅਸੀਂ ਜਲਦੀ ਤੋਂ ਜਲਦੀ ਲਿਖ ਸਕਦੇ ਆਪਣੇ ਕੁਸਚਨ ਕੰਪਲੀਟ ਕਰ ਸਕਦੇ ਹਾਂ ਇਸ ਤਰੀਕੇ ਨਾਲ ਜੇ ਅਸੀਂ ਪੈੱਨ ਫੜਾਂਗੇ ਨਹੀਂ ਤਾਂ ਸਾਨੂੰ ਲਿਖਣਾ ਨਹੀਂ ਆਏਗਾ ਪੇਪਰ ਦੇ ਵਿੱਚ ਸਾਡੇ ਕੁਛ ਕੁਸ਼ਚਨ ਜੋ ਹੈ ਉਹ ਛੁੱਟ ਵੀ ਜਾਣਗੇ ਜੋ ਕਿ ਸਾਡੇ ਦਿਲ ਸਾਡੇ ਲਈ ਵਧੀਆ ਨਹੀਂ ਹੈ ਪਰ ਇਹ ਕੀ ਮੈਂ ਚਾਹੁੰਦੀ ਹਾਂ ਵੀ ਟਾਈਪਿੰਗ ਵੀ ਜ਼ਰੂਰੀ ਏ ਅਤੇ ਲਿਖਣਾ ਵੀ ਜ਼ਰੂਰੀ ਹੈ ਪਰ ਅੱਜ ਦੇ ਬੱਚੇ ਮੈਂ ਕਈ ਮੈਂ ਇੰਗਜ਼ਪਲ ਦੇ ਤੌਰ 'ਚ ਮੇਰਾ ਬੇਟਾ ਹੀ ਲੈ ਲੈ ਲਉ ਉਹ ਲਿਖਣਾ ਉਹਨੂੰ ਲਿਖਣਾ ਬਿਲਕੁਲ ਪਸੰਦ ਨਹੀਂ ਹੈਗਾ ਜੇਕਰ ਫੋਨ 'ਚ ਵੀ ਉਹ ਸਪੀਕ ਕਰ ਲੈਂਦਾ ਏ ਅਤੇ ਉਹ ਫਤਾ ਫਟਾਫਟ ਉਹ ਸਾਰੀ ਤ ਡਿਸਪਲੇ ਤੁਹਾਡੇ ਸਾਹਮਣੇ ਆ ਜਾਂਦੀ ਜੋ ਤੁਸੀਂ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਉਹ ਵੀ ਮੈਂ ਉਹਨੂੰ ਵੀ ਫੋਰਸ ਕਰਦੀ ਹਾਂ ਕੀ ਬੇਟਾ ਜੇ ਤੂੰ ਟਾਈਪ ਕਰ ਰਿਹਾਂ ਬਹੁਤ ਵਧੀਆ ਗੱਲ ਆ ਪਰ ਇਸ ਦੇ ਨਾਲ ਤੂੰ ਲਿਖਣਾ ਵੀ ਸਿੱਖ ਕਿਉਂਕਿ ਜੇ ਲਿ ਲਿਖੇਂਗਾ ਤਾਂ ਤੇਰੀ ਹੈਂਡਰਾਈਟਿੰਗ ਸਾਫ ਹੋਏਗੀ ਹੈਂਡਰਾਈਟਿੰਗ ਸਾਫ ਹੋਏਗੀ ਤਾਂ ਤੇਰੇ ਪੇਪਰ ਦੇ ਵਿੱਚ ਨੰਬਰ ਵਧੀਆ ਆਉਣਗੇ ਤੇਰੀ ਵਧੀਆ ਪੁਜੀਸ਼ਨ ਆਏਗੀ